ਮੈਂ ਜਲੰਧਰ ਸ਼ਹਿਰ ਤੋਂ ਬੋਲ ਰਿਹਾ ਹਾਂ ਮੈਂ ਤਰੀਕ ਇੱਕ ਦੋ ਸ਼ੂਨਿਆ ਦੋ ਦੋ ਸ਼ੂਨਿਆ ਦੋ ਪੰਜ ਨੂੰ ਜਲੰਧਰ ਤੋਂ ਦਿੱਲੀ ਜਾਣ ਲਈ ਸ਼ਾਨੇ ਪੰਜਾਬ ਰੇਲ ਗੱਡੀ ਵਿੱਚ ਸੀਟ ਬੁੱਕ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਮੈਂ ਉਸ ਦਿਨ ਯਾਤਰਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਉਹ ਕਾਰਨ ਵੀ ਦੱਸ ਦਿੰਦਾ ਹਾਂ ਕਿ ਮੇਰੇ ਸਹੁਰਾ ਸਾਹਿਬ ਕਾਫੀ ਬਿਮਾਰ ਹੋ ਗਏ ਜਿਸ ਕਰਕੇ ਮੈਨੂੰ ਜਲੰਧਰ ਤੋਂ ਅੰਮ੍ਰਿਤਸਰ ਜਾਣਾ ਪਿਆ ਅਤੇ ਉਸ ਦਿਨ ਮੈਂ ਦਿੱਲੀ ਜਾਣ ਦੀ ਯਾਤਰਾ ਨਹੀਂ ਕਰ ਸਕਦਾ ਜਿਸ ਮੇ ਮੈਂ ਆਪਣੀ ਸੀਟ ਨੂੰ ਰੱਦ ਕਰਵਾਉਣਾ ਚਾਹੁੰਦਾ ਹਾਂ ਜਿਸ ਦਾ ਪੀਐਨਆਰ ਨੰਬਰ ਹੈ ਦੋ ਚਾਰ ਛੇ ਅੱਠ ਅੱਠ ਛੇ ਚਾਰ ਦੋ ਇੱਕ ਨੌਂ ਉਪਭੋਗਤਾ ਆਈਡੀ ਛੇ ਇੱਕ ਅੱਠ ਦੋ ਪੰਜ ਅਤੇ ਪਾਸਵਰਡ ਦੋ ਦੋ ਤਿੰਨ ਚਾਰ ਹੈ ਕਿਰਪਾ ਕਰਕੇ ਮੇਰੀ ਸੀਟ ਰੱਦ ਕਰਨ ਵਿੱਚ ਮੇਰੀ ਸਹਾਇਤਾ ਕਰੋ ਤਾਂ ਕਿ ਮੈਂ ਅਗਲੀ ਤਰੀਕ ਦੀ ਸੀਟ ਬੁੱਕ ਕਰਵਾ ਸਕਾਂ ਇਸ ਲਈ ਮੈਂ ਤੁਹਾਡਾ ਬਹੁਤ ਅਭਾਰੀ ਹੋਵਾਂਗਾ ਅਤੇ ਮੈਨੂੰ ਪਤਾ ਹੈ ਤੁਸੀਂ ਉਪਭੋਗਤਾ ਦੀ ਮਦਦ ਬਹੁਤ ਵਧੀਆ ਢੰਗ ਨਾਲ ਕਰਦੇ ਹੋ ਕਿਰਪਾ ਕਰਕੇ ਮੇਰੀ ਮਦਦ ਕਰੋ ਮੇਰੀ ਸੀਟ ਰੱਦ ਕਰਵਾਉਣ ਦੇ ਵਿੱਚ